ਹਾਂਜੀ ਯੋਗਾ ਦਾ ਮੇਰੇ ਤਾਂ ਜੀਵਨ ਚ ਬਹੁਤ ਹੀ ਵੱਡਾ ਮਹੱਤਵ ਯੋਗਾ ਤਾਂ ਮੇਰੇ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੋਇਆ ਇਹਦੇ ਬਿਨਾ ਮੈਂ ਜੀਅ ਨਹੀਂ ਸਕਦੀ ਮੇਰੀ ਇਹਦੇ ਨਾਲ ਇੰਨੀ ਜਿਆਦਾ ਅਟੈਚਮੈਂਟ ਹੋ ਗਈ ਜਿਵੇਂ ਕਿ ਇਨਸਾਨ ਦੀ ਪਾਣੀ ਨਾਲ ਹੁੰਦੀ ਆ ਪਾਣੀ ਬਿਨਾਂ ਇਨਸਾਨ ਮਰ ਜਾਂਦਾ ਰਹਿ ਨਹੀਂ ਸਕਦਾ ਈਂ ਹੀ ਇਵੇਂ ਹੀ ਮੈਂ ਯੋਗੇ ਬਿਨਾਂ ਹੀਂ ਰਹਿ ਸਕਦੀ ਯੋਗਾ ਮੇਰੀ ਜਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਬਣ ਗਿਆ ਹੋਇਆ ਸੁੱਤੇ ਉੱਠਦੇ ਹੀ ਸਭ ਤੋਂ ਪਹਿਲੇ ਆਪਣਾ ਦਿਨ ਇੱਥੋਂ ਹੀ ਸ਼ੁਰੂ ਕਰੀਦਾ ਯੋਗਾ ਤੋਂ ਸਭ ਤੋਂ ਪਹਿਲੇ ਪਾਰਕ ਚੇ ਨਿਕਲ ਜਾਈਦਾ ਯੋਗਾ ਕਰਕੇ ਇੱਕ ਡੇਢ ਘੰਟਾ ਤਰੋ ਤਾਜੀ ਹਵਾ ਲੈ ਕੇ ਤਾਂ ਫਿਰ ਘਰ ਨੂੰ ਆਈ ਆ ਵਾਪਸ ਹੁੰਦਾ ਇਹਦੇ ਨਾਲ ਮੇਰਾ ਮਨ ਬਹੁਤ ਖੁਸ਼ ਹੁੰਦਾ ਬਹੁਤ ਪ੍ਰਸੰਨਤਾ ਮਿਲਦੀ ਹ ਮੇਰੀਆਂ ਕਈ ਬਿਮਾਰੀਆਂ ਦੂਰ ਹੋਈਆਂ ਮੈਂ ਤਾਂ ਹਰ ਕਿਸੇ ਨੂੰ ਕਹੂੰਗਾ ਯੋਗਾ ਜਰੂਰ ਕਰੋ ਯੋਗਾ ਤੁਹਾਡੀ ਜ਼ਿੰਦਗੀ ਦਾ ਬਹੁਤ ਹੀ ਵੱਡਾ ਰੋਲ ਆ ਤੁਹਾਡੀ ਜ਼ਿੰਦਗੀ ਚ ਇਹ ਤੁਹਾਡੇ ਜ ਬਹੁਤ ਹੀ ਅਹਿਮ ਰੋਲ ਨਿਭਾਉਂਦਾ ਆ ਅਗਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੂਰੀ ਆਪਣੀ ਦਿਲੋ ਜਾਨ ਨਾਲ ਕਰਦੇ ਆ ਤਾਂ ਇਹਦੇ ਚ ਤੁਸੀਂ ਇਹਦੇ ਬਹੁਤ ਬੈਨੀਫਿਟ ਲੈਣੇ ਬਹੁਤ ਹੀ ਲਾਭ ਲੈਨੇ ਆ ਇਹਦੇ ਚ ਤੁਹਾਨੂੰ ਬਹੁਤ ਫਾਇਦਾ ਦਿੰਦੇ ਆ ਬਸ ਇਹ ਕਹਿੰਦੇ ਨਾ ਕੁਝ ਪਾਉਣ ਲਈ ਕੁਛ ਹੋਣਾ ਪੈਂਦਾ ਇਸ ਕਰਕੇ ਤੁਹਾਨੂੰ ਯੋਗਾ ਸਵੇਰੇ ਉੱਠਣਾ ਆ ਚਾਰ ਵਜੇ ਸਵੇਰੇ ਉੱਠ ਕੇ ਯੋਗਾ ਘੰਟਾ ਕਰੋ ਤਾਂ ਇਹ ਆ ਕੀ ਇਹਦੇ ਤੁਹਾਨੂੰ ਬਹੁਤ ਜਿਆਦਾ ਲਾਭ ਮਿਲੂਗੇ